ਸਾਡੀ ਖੇਤਰ ਵਿੱਚ ਕਲਾਕਾਰ ਅਤੇ ਸ਼ਿਲਪਕਾਰੀ ਖੇਤਰਾਂ ਵਿੱਚ ਰਾਜ ਦੇ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਪਰੰਪਰਾਵਾਂ ਪਰੰਪਰਾਵਾਂ ਨੂੰ ਦੇਖ ਕੇ ਵਿਅਕਤੀ ਨੂੰ ਇੱਕ ਸੇਧ ਮਿਲਦੀ ਹੈ ਉਸ ਨੂੰ ਆਪਣੇ ਪੁਰਾਤਨ ਸਮੇਂ ਵਾਲੀਆਂ ਪਰੰਪਰਾਵਾਂ ਬਾਰੇ ਪਤਾ ਚਲਦਾ ਹੈ ਅਤੇ ਰਾਜ ਵਿੱਚ ਵੱਖ ਵੱਖ ਧਰਮ ਦੇ ਲੋਕ ਹੁੰਦੇ ਹਨ ਅਤੇ ਵੱਖ ਵੱਖ ਧਰਮ ਦੇ ਲੋਕਾਂ ਦੇ ਵੱਖ ਵੱਖ ਚਿੰਨ੍ਹ ਅਤੇ ਮੂਲ ਆਉਂਦੇ ਹਨ ਕਿਉਂਕਿ ਹਰੇਕ ਧਰਮ ਦਾ ਆਪਣਾ ਪਛਾਣ ਚਿੰਨ ਜ਼ਰੂਰੀ ਹੁੰਦਾ ਹੈ